ਮੇਰੇ ਸੁਝਾਅ ਮੁਤਾਬਿਕ ਉਸ ਵਿਅਕਤੀ ਨੂੰ ਜੋ ਗਾਉਣਾ ਸ਼ੁਰੂ ਕਰਨਾ ਚਾਹੁੰਦਾ ਹੈ ਕਿ ਉਹ ਆਪਣੇ ਬੋਲਾਂ ਵਿੱਚ ਚੰਗੇ ਗੀਤ ਗਾਵੇ ਅਤੇ ਉਸ ਦੇ ਗੀਤਾਂ ਰਾਹੀਂ ਲੋਕਾਂ ਵਿੱਚ ਚੰਗਾ ਸੰਦੇਸ਼ ਜਾਵੇ ਗੀਤਕਾਰੀ ਸਮਾਜ ਦਾ ਦਰਪਣ ਹੁੰਦੀ ਹੈ ਇਸ ਗਾਇਕ ਗਾਇਕ ਨੂੰ ਸਮਾਜ ਪ੍ਰਤੀ ਆਪਣਾ ਫਰਜ਼ ਨਿਭਾਉਂਦੇ ਹੋਏ ਜ਼ਰੂਰੀ ਹੈ ਕਿ ਉਹ ਸਾਫ਼ ਸੁਥਰੀ ਗਾਇਕੀ ਅਪਣਾਵੇ ਆਪਣੇ ਬੋਲਾਂ ਵਿੱਚ ਲੱਚਰਤਾ ਨਾ ਆਉਣ ਦੇਵੇ ਗੀਤਾਂ ਰਾਹੀਂ ਹੀ ਪੰਜਾਬੀ ਸੱਭਿਆਚਾਰ ਦੇ ਅਸਲ ਸਰੂਪ ਨੂੰ ਸਮਝਿਆ ਜਾ ਸਕਦਾ ਹੈ ਗਾਇਕੀ ਹੀ ਆਪਣੇ ਵਿਰਸੇ ਸੱਭਿਆਚਾਰ ਅਤੇ ਇਤਿਹਾਸ ਬਾਰੇ ਆਪਣੇ ਬੋਲਾਂ ਰਾਹੀਂ ਸਫ਼ਲਤਾ ਨਾਲ ਆਪਣਾ ਸੰਦੇਸ਼ ਲੋਕਾਂ ਤੱਕ ਪਹੁੰਚਾ ਸਕਦਾ ਹੈ ਇਸ ਲਈ ਲੋੜ ਹੈ ਹਰ ਗਾਇਕ ਆਪਣੇ ਸਮਾਜ ਪ੍ਰਤੀ ਫਰਜ ਨੂੰ ਸਮਝੇ ਅਤੇ ਸਾਰਥਕ ਵਿਚਾਰਾਂ ਦਾ ਧਾਰਨੀ ਬਣ ਕੇ ਚੰਗੀ ਗੀਤਕਾਰੀ ਲੋਕਾਂ ਅੱਗੇ ਪੇਸ਼ ਕਰੇ ਅਜਿਹਾ ਕਰਨ ਨਾਲ ਪੰਜਾਬੀ ਗੀਤਕਾਰੀ ਹੋਰ ਵੀ ਨਿਖਰ ਕੇ ਸਾਹਮਣੇ ਆਵੇਗੀ